ਸਤਿ ਸ਼੍ਰੀ ਅਕਾਲ ਜੀ ਮੋਹਨ ਢਾਬੇ ਤੋਂ ਗੱਲ ਕਰ ਰਹੇ ਹੋ ਜੀ ਮੈਂ ਤੁਹਾਡੇ ਕੋਲ ਇੱਕ ਦਾਲ ਮੱਖਣੀ ਸ਼ਾਹੀ ਪਨੀਰ ਪੰਜ ਤੰਦੂਰੀ ਰੋਟੀਆਂ ਮੰਗਵਾਉਣੀਆਂ ਹਨ ਮੇਰਾ ਪਤਾ ਪਾਵਰ ਕਲੋਨੀ ਰੋਪੜ ਹੈ ਮੈਂ ਪੇਮੈਂਂਟ ਔਨਲਾਈਨ ਕਰਦੂੰਗੀ ਕੀ ਤੁਸੀਂ ਮੈਨੂੰ ਡਿਸਕਾਊਂਟ ਦੇਵੋਗੇ ਜੇ ਕੋਈ ਛੋਟਾ ਕੂਪਨ ਜਾਂ ਪ੍ਰੋਮੋ ਕੋਡ ਹੈ ਤਾਂ ਮੈਨੂੰ ਉਸਦੀ ਜਾਣਕਾਰੀ ਦੇ ਦੇਵੋ ਆਪ ਜੀ ਦਾ ਧੰਨਵਾਦ